ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਠਾਕ ਹੋ ਅਸੀਂ ਠੀਕ ਅਤੇ ਤੁਸੀਂ ਅੱਜ ਕਿੱਥੇ ਗਏ ਸੀ ਠੀਕ ਤੇ ਉਥ ਹਾਂ ਫਿਰ ਉੱਥੇ ਕਿੰਨਾ ਟੈਮ ਲਾ 'ਤਾ ਹਾਂ ਅਤੇ ਆਪ ਜਿੱਥੇ ਗਏ ਸੀ ਠੀਕ ਹੈ ਕਾਰ ਫਿਰ ਠੀਕ ਰਹੀ ਕੀ ਹੋ ਗਿਆ ਸੀ ਅੱਛਾ ਅੱਛਾ ਅੱਛਾ

ਅੱਛਾ ਜੀ ਠੀਕ ਹੈ ਅਤੇ ਚਲੋ ਫਿਰ ਹੁਣ ਇੱਥੋਂ ਹੁਣ ਤੱਕ ਕਰ ਚਲ ਠੀਕ ਅੱਛਾ ਜੀ ਇੰਨਾ ਤੇਜ਼

ਅੱਛਾ ਅਤੇ ਇਹਨਾਂ ਨੇ ਬੱਚਿਆਂ ਨੇ ਉੱਥੇ ਰਾਤ ਫਿਰ ਪਾਸ ਕਰ ਲਿਆ ਸੀ ਅ ਸਵੇਰ ਦਾ ਵੀ ਅੱਛਾ ਪ੍ਰਸ਼ਾਦਾ ਪਾਣੀ ਫਿਰ ਕੀ ਸਬਜ਼ੀ ਬਣਾਈ ਸੀ ਅੱਛਾ ਅੱਛਾ ਜੀ ਠੀਕ ਹੈ ਅਤੇ ਵਧੀਆ ਫਿਰ ਉਹਨਾਂ ਨੇ ਸੇਵਾ ਵਧੀਆ ਕੀਤੀ ਹੈ

ਠੀਕ ਹੈ ਅਤੇ ਉਹ ਫਿਰ ਆਪਣੇ ਬੱਚੇ ਉਹ ਪੜ੍ਹਨ ਜਾਂਦੇ ਹੋਣਗੇ ਕੱਲ੍ਹ ਤਾਂ ਅੱਜ ਤਾਂ ਐਤਵਾਰ ਸੀ ਹਾਂਜੀ ਹਾਂਜੀ

ਹਾਂ ਹਾਂ ਪੇਪਰ ਇਹਨਾਂ ਦੇ ਚੱਲ ਰਹੇ ਨੇ ਅੱਛਾ ਅੱਛਾ ਠੀਕ ਆ ਇਹ ਇਹ ਤਾਂ ਇਹ ਤਾਂ ਦਿਲਜੀਤ ਦਾ ਠੀਕ ਆ ਮਾਰਚ ਤੋਂ ਸ਼ੁਰੂ ਨੇ ਠੀਕ ਆ ਇਹਨੂੰ ਕਿਹਾ ਕਰੋ ਨਾ ਤੇਰੀ ਜ਼ਿੰਮੇਵਾਰੀ ਇਹਨੂੰ ਪੜ੍ਹਾ ਇਹਨੂੰ ਕਹਿ ਪੜ੍ਹਿਆ ਕਰੇ ਪੂਰਾ ਧਿਆਨ ਦੇਵੇ ਹੁਣ ਪੜ੍ਹਾਈ ਵੱਲ ਹਾਂ ਆਹੀ ਤਾਂ ਦਿਨ ਹੁੰਦੇ ਨੇ ਪੜ੍ਹਨ ਦੇ ਪਹਿਲਾਂ ਤਾਂ ਚੱਲ ਹੌਲੀ ਹੌਲੀ ਹੁੰਦਾ ਹੁਣ ਤਾਂ ਧਿਆਨ ਇੱਧਰ ਲਾਉਣੇ ਪੇਪਰ ਨੇੜੇ ਨੇ ਇਹਨੂੰ ਕਿਹੋ ਬਸ ਪੜ੍ਹਿਆ ਕਰੇ ਨਿਤਨੇਮ ਕਰਕੇ ਬਸ ਪੜ੍ਹਾਈ 'ਤੇ ਜ਼ੋਰ ਲਾ ਦੇਵੇ ਹਾਂ ਵਾਹਿਗੁਰੂ ਖਾਲਸਾ ਜੀ ਫਤਿਹ